ਸਤਿ ਸ਼੍ਰੀ ਅਕਾਲ ਜੀ ਤੁਸੀਂ ਧਾਲੀਵਾਲ ਚੈਨਲ ਏਜੰਸੀ ਤੋਂ ਗੱਲ ਕਰੇ ਹੋ ਮੈਂ ਤੁਹਾਡੀ ਕੈਬ ਤਿੰਨ ਦਸ ਤੇਈ ਲਈ ਖਰੜ ਤੋਂ ਦਿੱਲੀ ਜਾਣ ਲਈ ਬੁੱਕ ਕਰਵਾਈ ਸੀ ਪਰ ਮੇਰੀ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਮੈਨੂੰ ਡੋਕਟਰ ਕੋਲ ਜਾਣਾ ਪਿਆ ਅਤੇ ਜਿਸਨੇ ਮੈਨੂੰ ਦੱਸਿਆ ਕਿ ਮੇਰਾ ਬੀ ਪੀ ਵਧ ਗਿਆ ਹੈ ਅਤੇ ਸਫਰ ਕਰਨ ਲਈ ਮਨ੍ਹਾਂ ਕੀਤਾ ਹੈ ਡੋਕਟਰ ਵੱਲੋਂ ਮੈਨੂੰ ਕੁਝ ਦਿਨਾਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਮੇਰੇ ਕੋਲੋਂ ਹੁਣ ਦਿੱਲੀ ਨਹੀਂ ਜਾਇਆ ਜਾਣਾ ਜੀ ਕਿਰਪਾ ਕਰਕੇ ਜੋ ਕੈਬ ਮੈਂ ਤੁਹਾਡੇ ਕੋਲੋਂ ਕੱਲ੍ਹ ਲਈ ਦਿੱਲੀ ਜਾਣ ਲਈ ਬੁੱਕ ਕਰਵਾਈ ਸੀ ਉਹ ਤੁਸੀਂ ਹੁਣ ਰੱਦ ਕਰ ਦਿਓ ਜੀ ਮੇਰੇ ਵੱਲੋਂ ਦੋ ਹਜ਼ਾਰ ਰੁਪਏ ਤੁਹਾਨੂੰ ਐਡਵਾਂਸ ਬੁਕਿੰਗ ਦੇ ਤੌਰ ਉੱਤੇ ਪੇ ਟੀ ਐੱਮ ਕੀਤੇ ਸਨ ਉਹਨਾਂ ਵਿੱਚੋਂ ਤੁਸੀਂ ਆਪਣੀ ਬਣਦੀ ਕਟੌਤੀ ਕੱਟ ਕੇ ਮੇਰੇ ਬਾਕੀ ਪੈਸੇ ਮੇਰੇ ਖਾਤੇ ਵਿੱਚ ਪੇ ਟੀ ਐੱਮ ਦੁਆਰਾ ਪਾ ਦਿਓ ਜੀ